ਜਦੋਂ ਅਸੀਂ ਨਾ ਪਹਿਲੀ ਵਾਰ ਕੁਛ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਅਸੀਂ ਬਣਾਉਣਾ ਕੀ ਆ ਫਿਰ ਅਸੀਂ ਦੇਖਦੇ ਹਾਂ ਜਿੰਨਾਂ ਮਟੀਰੀਅਲ ਉਹਦੇ ਵਿੱਚ ਵਰਤੋਂ ਆਉਂਦਾ ਹੈ ਨਾ ਵੀ ਉਹ ਸਾਡੇ ਕੋਲ ਹੈਗਾ ਵੀ ਹੈ ਕਿ ਨਹੀਂ ਜੇ ਪਹਿਲਾਂ ਅਸੀਂ ਉਹ ਮਟੀਰੀਅਲ ਕੱਢ ਕੇ ਰੱਖਦੇ ਹਾਂ ਫ਼ੋਰ ਐਗਜੈਂਪਲ ਅਸੀਂ ਮਿੱਠੇ ਚੌਲ ਬਣਾਉਣੇ ਆ ਪਹਿਲਾਂ ਦੇਖਦੇ ਹਾਂ ਅਸੀਂ ਸਾਡੇ ਕੋਲ ਚੌਲ ਹੈਗੇ ਨੇ ਫਿਰ ਉਹ ਤੋਂ ਬਾਅਦ ਦੇਖਦੇ ਮਿੱਠਾ ਹੈਗਾ ਜੇ ਇਹ 'ਚ ਅਸੀਂ ਰੰਗ ਵਗੈਰਾ ਐਡ ਕਰਦੇ ਹਾਂ ਫਿਰ ਅਸੀਂ ਦੇਖਦੇ ਹਾਂ ਵੀ ਇਹ 'ਚ ਰੰਗ ਪਾਉਣ ਨੂੰ ਰੰਗ ਹੈ ਫਿਰ ਅਸੀਂ ਕੜਾਹੀ ਲੈਂਦੇ ਹਾਂ ਕੜਾਹੀ ਲੈ ਕੇ ਫਿਰ ਉਹਨੂੰ ਪਹਿਲਾਂ ਚੌਲਾਂ ਨੂੰ ਅਲੱਗ ਤੋਂ ਛਾਣ ਕੇ ਦੇਖਦੇ ਹਾਂ ਉਹ 'ਚ ਕੋਈ ਚੀਜ਼ ਤਾਂ ਨਹੀਂ ਹੈਗੀ ਸੂਸਰੀ ਵਗੈਰਾ ਜਾਂ ਕੋਈ ਹੋਰ ਚੀਜ਼ ਫਿਰ ਅਸੀਂ ਉਹਨੂੰ ਛਾਂਟਦੇ ਹਾਂ ਛਾਂਟ ਕੇ ਧੋ ਲੈਂਦੇ ਹਾਂ ਧੋ ਕੇ ਅਲੱਗ ਇੱਕ ਸਾਈਡ 'ਤੇ ਰੱਖਦੇ ਹਾਂ ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਗੈਸ 'ਤੇ ਰੱਖਦੇ ਹਾਂ ਗੈਸ 'ਤੇ ਭਾਂਡਾ ਰੱਖ ਕੇ ਉਹ ਵੀ ਵਿੱਚ ਦੇਸੀ ਘੀ ਪਾ ਕੇ ਜਾਂ ਇਲਾਇਚੀ ਵਗੈਰਾ ਪਾਉਣੀ ਕੁਛ ਹੋਰ ਚੀਜ਼ ਪਾਉਣੀ ਆ ਲੌਂਗ ਪਾਉਣੇ ਆ ਉਹ ਪਾ ਦਿੰਦੇ ਹਾਂ ਮਤਲਬ ਇਕ ਤੜਕਾ ਜਿਹਾ ਕਹਿ ਸਕਦੇ ਪੰਜਾਬੀ ਦੇ ਵਿੱਚ ਉਹਨੂੰ ਅਸੀਂ ਭੁੰਨ ਲੈਂਦੇ ਹਾਂ ਫਿਰ ਉਦੋਂ ਉਹਦੇ ਵਿੱਚ ਚੌਲ ਅਸੀਂ ਐਡ ਕਰ ਦਿੰਦੇ ਹਾਂ ਚੌਲਾਂ ਨੂੰ ਐਡ ਕਰਨ ਤੋਂ ਬਾਅਦ ਉਹਦੇ 'ਚ ਚੀਨੀ ਪਾ ਦਿੰਦੇ ਹਾਂ ਚੀਨੀ ਪਾ ਕੇ ਗਰਮ ਜਿਹੜਾ ਪਾਣੀ ਇੱਕ ਸਾਈਡ 'ਤੇ ਕੀਤਾ ਹੋਇਆ ਸੀ ਉਹ ਪਾਣੀ ਪਾ ਦਿੰਦੇ ਹਾਂ ਢੱਕ ਦਿੰਦੇ ਹਾਂ ਢੱਕ ਕੇ ਫਿਰ ਜਦੋਂ ਸਟੀਮ ਬਣਦੀ ਆ ਉਹਦੀ ਤਾਂ ਫਿਰ ਸਾਡੇ ਚੌਲ ਨੇ ਜਿਹੜੇ ਸਵੀਟ ਸਵੀਟ ਮਿੱਠੇ ਮਿੱਠੇ ਬਹੁਤ ਉਹ ਤਿਆਰ ਹੋ ਜਾਂਦੇ ਨੇ